ਮੈਂ ਕਿਸਾਨ ਹਾਂ ਜੀ ਮੈਂ ਖੇਤੀ ਕਰਦਾ ਹੈ ਜੀ ਅਤੇ ਗਰਮੀਆਂ ਵਿੱਚ ਕਣਕ ਅਤੇ ਹੋਰ ਝੋਨਾ ਝੁਨਾ ਝੋਨਾ ਲਾ ਲਈਦਾ ਸਰਦੀਆਂ 'ਚ ਝੋਨਾ ਜੀ ਅਤੇ ਬਰਸੀਨ ਵਗੈਰਾ ਅਤੇ ਮੱਕੀ ਵਗੈਰਾ ਸਾਰਾ ਕੁਛ ਬੀਜਦੇ ਹਾਂ ਜੀ ਫਸਲ ਉਗਾਉਂਦੇ ਹਾਂ ਜੀ ਅਤੇ ਜਦ ਫਸਲ ਕੱਟਣ 'ਤੇ ਆਉਂਦੀ ਆ ਜੀ ਕੱਟ ਕੇ ਅਸੀਂ ਸਭ ਤੋਂ ਪਹਿਲਾਂ ਜੀ ਗੁਰਦੁਆਰਾ ਸਾਹਿਬ ਵਿੱਚ ਚੜਾਉਂਦੇ ਹਾਂ ਜੀ ਅਤੇ ਜ਼ਰੂਰਤਮੰਦ ਜਿਵੇਂ ਕੋਈ ਪਿੰਡ ਦੇ ਵਿੱਚ ਗਰੀਬ ਹੁੰਦਾ ਜੀ ਉਹਨੂੰ ਦੇ ਦਿੰਦੇ ਹਾਂ ਜੀ ਖੁਸ਼ੀ ਖੁਸ਼ੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਵੀ ਫਸਲ ਕਰਦੇ ਹਾਂ ਜੀ ਪਹਿਲਾਂ ਜਿਵੇਂ ਪਹਿਲਾਂ ਦੀ ਪਹਿਲਾਂ ਬਾਰੇ ਸੁਣੋ ਖੇਤੀ ਕਿਵੇਂ ਕਰਦੇ ਸੀ ਬਲਦਾਂ ਨਾਲ ਖੇਤੀ ਕਰਦੇ ਸੀ ਬਹੁਤ ਵਧੀਆ ਹੁੰਦਾ ਸੀ ਜਦ ਵੀ ਸਮਾਂ ਹੁਣ ਚੱਲੋ ਮਸ਼ੀਨਰੀ ਹੋ ਗਈ ਜੀ ਸਾਰਾ ਪਹਿਲਾਂ ਹੱਥੀ ਹੁੰਦਾ ਸੀ ਹੁਣ ਮਸ਼ੀਨਰੀ ਹੋ ਗਈ ਜੀ ਸਾਰਾ ਮਸ਼ੀਨਰੀ ਦੇ ਨਾਲ ਕੰਮ ਹੁੰਦਾ ਜੀ ਸੌਖਾ ਕਰਤਾ ਜੀ ਹੁਣ ਕੰਮ ਸਾਰਾ ਚੱਲੋ ਬਹੁਤ ਵਧੀਆ ਹੋਇਆ ਜੀ